ਜ਼ਿੰਦਗੀ ਵਿੱਚ ਹਰੇਕ ਇਨਸਾਨ ਗਲਤੀਆਂ ਬਹੁਤ ਕਰਦਾ ਅਤੇ ਮੈਂ ਵੀ ਐਵੇਂ ਮੈਨੂੰ ਗਾਉਣ ਦਾ ਸ਼ੌਂਕ ਸੀਗਾ ਅਤੇ ਜਦੋਂ ਮੈਂ ਆਪਣਾ ਗਾਣਾ ਰਿਕੋਡ ਕਰਨ ਗਿਆ ਸੀਗਾ ਉਸ ਟਾਈਮ ਮੇਰੇ ਕੋਲੋਂ ਵੀ ਇੱਕ ਗਲਤੀ ਹੋਈ ਅਤੇ ਉਹ ਗਲਤੀ ਐਵੇਂ ਸੀ ਕਿ ਮੈਂ ਸੈਡ ਸੌਂਗ ਆਪਣਾ ਰਿਕੋਡ ਕਰ ਰਿਹਾ ਸੀਗਾ ਅਤੇ ਸੈਡ ਸੌਂਗ ਰਿਕੋਡ ਕਰਦੇ ਕਰਦੇ ਉਹ ਮਤਲਬ ਜਦੋਂ ਗਾਣਾ ਰਿਕੋਡ ਕਰਦੇ ਹਾਂ ਉਦੋਂ ਨਾ ਟੈਂਪੋ 'ਤੇ ਹੁੰਦਾ ਉਹ ਗਾਣਾ ਰਿਕੋਡ ਮਤਲਬ ਬੀਟ ਵਗੈਰਾ ਬਾਅਦ 'ਚ ਮਿਊਜ਼ਿਕ ਉਹਦਾ ਬਾਅਦ 'ਚ ਬਣਦਾ ਅਤੇ ਜਦੋਂ ਉਹਦੇ 'ਤੇ ਟੈਂਪੋ 'ਤੇ ਗਾਣਾ ਰਿਕੋਡ ਹੋ ਰਿਹਾ ਸੀਗਾ ਅਤੇ ਉਸ ਟਾਈਮ ਮੈਂ ਗਾਣਾ ਇੰਨੀ ਕਾਹਲੀ 'ਚ ਗਾ ਤਾ ਉਹ ਵੀ ਗਾਉਣਾ ਸੈਡ ਸੀਗਾ ਅਤੇ ਉਹ ਬੀਟ ਸੌਂਗ ਬਣ ਗਿਆ ਵੀ ਹਾਂ ਲੱਗੇ ਲੈਅ ਹੋ ਗਈ ਉਹਦੀ ਅਤੇ ਬਾਅਦ 'ਚ ਜਦੋਂ ਮੈਨੂੰ ਪਤਾ ਲੱਗਿਆ ਆ ਮੈਨੂੰ ਮ ਮੇਰੇ ਦੋਸਤ ਨੇ ਦੱਸਿਆ ਜਿਹੜਾ ਮਿਊਜ਼ਿਕ ਬਣਾ ਰਿਹਾ ਸੀਗਾ ਉਹਨੇ ਉਹਦੇ 'ਤੇ ਚਾਨਣਾ ਪਾਇਆ ਕਹਿੰਦਾ ਵੀ ਐਵੇਂ ਨਹੀਂ ਕਹਿੰਦਾ ਆਹ ਸਹੀ ਨਹੀਂ ਹੈਗਾ ਤੇਰਾ ਅਤੇ ਚਲੋ ਜਦੋਂ ਉਹ ਮੈਨੂੰ ਪਤਾ ਲੱਗਿਆ ਫਿਰ ਬਾਅਦ 'ਚ ਮੈਂ ਫਿਰ ਤੋਂ ਦੁਬਾਰਾ ਤੋਂ ਜਦੋਂ ਗਾਣਾ ਰਿਕੋਡ ਕਰਿਆ ਫਿਰ ਮੈਨੂੰ ਪਤਾ ਲੱਗਿਆ ਵੀ ਹਾਂ ਇਹਨੂੰ ਸੈਡ ਤਰੀਕੇ ਨਾਲ ਮਤਲਬ ਫੀਲ ਕਰਕੇ ਫਿਰ ਗਾਉਣਾ ਅਤੇ ਜਦੋਂ ਮੈਂ ਦੁਬਾਰਾ ਫਿਰ ਫੀਲ ਕਰਕੇ ਗਾਇਆ ਅਤੇ ਉਸ ਤੋਂ ਬਾਅਦ ਉਹ ਗਾਣਾ ਬਾਕਈ ਬਹੁਤ ਸੋਹਣਾ ਬ ਬਣ ਗਿਆ ਅਤੇ ਬਾਕੀ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਹੋਰ ਜਿੰਨੇ ਵੀ ਸੀਗੇ ਮੇਰੇ ਨਾਲ ਸੰਬੰਧਿਤ ਬੰਦੇ ਉਹਨਾਂ ਨੂੰ ਭੇਜਿਆ ਜਦੋਂ ਅਤੇ ਉਹਨਾਂ ਨੂੰ ਵੀ ਗਾਣਾ ਉਹ ਬਹੁਤ ਵਧੀਆ ਲੱਗਿਆ ਅਤੇ ਐਵੇਂ ਕਰਕੇ ਮੈਂ ਮਸਾਂ ਹੀ ਆਪਣੀ ਗਲਤੀ ਨੂੰ ਸੰਭਾਲਿਆ